ਕਿਹਾ ਜਾਂਦਾ ਹੈ ਕਿ ਲੋਕਤੰਤਰ ਦਾ ਜਿਹੜਾ ਚੌਥਾ ਥੰਮ ਹੈ ਉਹ ਪ੍ਰੈਸ ਹੈ ਜਾਂ ਕਹਿ ਦਈਏ ਕਿ ਨਿਊਜ ਮੀਡੀਆ ਹੈ ਅਤੇ ਨਿਊਜ਼ ਮੀਡੀਆ ਜਿਹੜਾ ਉਹ ਪੰਜਾਬ ਦੇ ਵਿੱਚ ਨਹੀਂ ਇਕੱਲਾ ਪੂਰੇ ਹਿੰਦੁਸਤਾਨ ਦੇ ਵਿੱਚ ਔਰ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਨਿਊਜ਼ ਮੀਡੀਆ ਬਹੁਤ ਵਧੀਆ ਤਰੀਕੇ ਨਾਲ ਸ ਸਿੱਖਿਆ ਅਤੇ ਸਿਹਤ ਸੰਭਾਲ ਮੁੱਦਿਆਂ ਨੂੰ ਕਵਰ ਕਰਦਾ ਹੈ ਕਿੱਦਾਂ ਕਵਰ ਕਰਦਾ ਜਾਨੀ ਕਿ ਅੱਜ ਜੇ ਸਕੂਲਾਂ ਦੀ ਹਾਲਤ ਮਾੜੀ ਏ ਕਿਤੇ ਅਧਿਆਪਕ ਨਹੀਂ ਹੈ ਉਸ ਗੱਲ ਨੂੰ ਨਿਊਜ਼ ਮੀਡੀਆ ਦੇ ਰਾਹੀਂ ਉਭਾਰਿਆ ਜਾਂਦਾ ਨਿਊਜ਼ ਮੀਡੀਆ ਉਸ ਗੱਲ ਨੂੰ ਉਭਾਰਦਾ ਹੈਗਾ ਜਿਸ ਕਿਸੇ ਸਿਹਤ ਕੇਂਦਰ ਦੇ ਵਿੱਚ ਡੋਕਟਰ ਨਹੀਂ ਹੈ ਤਾਂ ਉੱਥੇ ਉਹਨੂੰ ਉਸ ਗੱਲ ਨੂੰ ਨਿਊਜ਼ ਮੀਡੀਆ ਦੇ ਵਿੱਚ ਉਭਾਰਿਆ ਜਾਂਦਾ ਹੈ ਅੱਜ ਕੱਲ੍ਹ ਤਾਂ ਨਿਊਜ਼ ਮੀਡੀਆ ਜਿਹੜੇ ਅੱਡ ਅੱਡ ਚੈਨਲਾਂ ਤੋਂ ਬਿਨਾਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਜ਼ਿਆਦਾ ਮਤਲਬ ਸਰਗਰਮ ਹੈਗੇ ਆ ਜਿਹਦੇ ਨਾਲ ਕੀ ਫਾਇਦਾ ਹੋ ਰਿਹਾ ਕਿ ਜਿਹੜੀਆਂ ਏਜੰਸੀਆਂ ਜਿਹੜੀਆਂ ਸਰਕਾਰ ਹੈ ਉਹ ਕਾਫੀ ਵਧੀਆ ਤਰੀਕੇ ਨਾਲ ਫਿਰ ਕੰਮ ਕਰਦੀ ਹੈ ਜਦੋਂ ਉਹਨਾਂ ਕੋਲੇ ਗੱਲ ਪਹੁੰਚਦੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਨਿਊਜ਼ ਮੀਡੀਆ ਦੇ ਰਾਹੀਂ ਤਾਂ ਉਹ ਇਸ ਗੱਲ ਨੂੰ ਬਹੁਤ ਜਲਦੀ ਕਵਰ ਕਰਦੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਵੇ ਉਹ ਚਾਹੇ ਉਹ ਸਿੱਖਿਆ ਸੰਬੰਧੀ ਹੈ ਚਾਹੇ ਉਹ ਸਿਹਤ ਸੰਬੰਧੀ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਕੋਈ ਦੋ ਰਾਏ ਨਹੀਂ ਕਿ ਅੱਜ ਤੋਂ ਕੁਛ ਸਮਾਂ ਪਹਿਲਾਂ ਸਿੱਖਿਆ ਦੇ ਸਿਹਤ ਦੇ ਨਾਲ ਜਿਹੜਾ ਕਾਫੀ ਸਮੱਸਿਆਵਾਂ ਸੀ ਕਾਫੀ ਕਹਿ ਲਈਏ ਜੇ ਖਿਲਵਾੜ ਹੋ ਰਿਹਾ ਸੀ ਤਾਂ ਨਿਊਜ਼ ਮੀਡੀਆ ਜਦੋਂ ਦਾ ਹੋਂਦ ਦੇ ਵਿੱਚ ਆਇਆ ਹੈਗਾ ਵਧੀਆ ਤਰੀਕੇ ਦੇ ਨਾਲ ਜਾਂ ਕਹਿ ਲਈਏ ਸੋਸ਼ਲ ਮੀਡੀਆ ਹੋਂਦ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਕਾਫੀ ਮਤਲਬ ਇਹ ਜਿਹੜੀ ਹੈ ਫਰਕ ਪਿਆ ਹੈਗਾ ਤਾਂ ਉਹ ਇਹਨਾਂ ਨੂੰ ਜਦੋਂ ਕਵਰ ਕਰਨ ਲੱਗਿਆ ਵੀਡੀਓ ਦੇ ਰਾਹੀਂ ਖਬਰਾਂ ਦੇ ਰਾਹੀਂ ਨਿਊਜ਼ ਦੇ ਰਾਹੀਂ ਤਾਂ ਉਸਨੂੰ ਔਨ ਲਾਈਵ ਹੋ ਕੇ ਤਾਂ ਉਹ ਸਾਰਾ ਕਰਨ ਦੇ ਨਾਲ ਜਿਹੜੀਆਂ ਲੋਕਾਂ ਨੇ ਸਮੱਸਿਆਵਾਂ ਨੂੰ ਸੁਣਨਾ ਅਤੇ ਲੋਕਾਂ ਉਹਦੇ ਉੱਤੇ ਉਹਨੂੰ ਕਾ ਕਾਰਵਾਈ ਕਰਨੀ ਇਹ ਸਰਕਾਰ ਦੀ ਜ਼ਿੰਮੇਵਾਰੀ ਬਣੀ ਹੈ ਅਤੇ ਸਰਕਾਰ ਨੂੰ ਉਹ ਕਰਨੀ ਪਈ ਹੈ ਕਿਉਂਕਿ ਨਿਊਜ਼ ਮੀਡੀਆ ਜਿਹੜਾ ਸਿੱਖਿਆ ਅਤੇ ਸਿਹਤ ਨੂੰ ਵਧੀਆ ਤਰੀਕੇ ਨਾਲ ਕਵਰ ਕਰਦਾ ਹੈਗਾ